ਸਾਸਰੀਕਾਲ ਜੀ ਪੰਜਾਬ ਵਿੱਚ ਪ੍ਰਮੁੱਖ ਵਪਾਰਕ ਸੰਸਥਾਵਾਂ ਹਨ ਜੋ ਰਾਜ ਵਿੱਚ ਕਾਰੋਬਾਰਾਂ ਦੇ ਹਿੱਤਾਂ ਦੀ ਨੁਮਾਇੰਦੀ ਕਰਦੀਆਂ ਹਨ ਇਹਨਾਂ ਇਹਨਾਂ ਸੰਸਥਾਵਾਂ ਨੂੰ ਅਮੁਲਕ ਯੋਗਦਾਨ ਦਿੱਤਾ ਹੈ ਉਹਨਾਂ ਦੇ ਸੰਸਾਰ ਸੰ ਸਹਿਯੋਗ ਅਤੇ ਹਲਕੇ ਪੱਧਰ 'ਤੇ ਉਦਾਰਤਾ ਦੇ ਮਾਧਿਅਮ ਰਾਜ ਵਿੱਚ ਸਰਕਾਰ ਦੇ ਨਾਲ ਮਿਲ ਕੇ ਵਪਾਰ ਨੂੰ ਦੇਵ ਬਾਹਰ ਪ੍ਰਵਾਹ ਨੂੰ ਬੜਾ ਕਰਨ ਦੀ ਵਿੱਚ ਮਦਦ ਕੀਤੀ ਹੈ ਪੰਜਾਬ ਦੇ ਕਿਸੇ ਵੀ ਰਾਜ ਵਿੱਚ ਵਪਾਰ ਦੀ ਗਤੀ ਲਈ ਚੈਂਬਰ ਅੋਫ ਕਮਰਸ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ ਇਹ ਸੰਸਥਾ ਵਪਾਰੀ ਮੁਦਰਾ ਨਾਲ ਸਮਾਜ ਸਰਕਾਰ ਅਤੇ ਉਦਯੋਗੀਆਂ ਦੀ ਸੰਸਥਾ ਨੂੰ ਬਡਾਵਾ ਦੇਣ ਵਿੱਚ ਮਦਦ ਕਰਦੀ ਹੈ ਅਤੇ ਚਾਰਟਰ ਅਕਾਊਟਸ ਵਕੀਲਾਂ ਲਈ ਅਨੇ ਵਪਾਰੀ ਗਰੁੱਪ ਨਾਲ ਮਿਲਕਵ ਵਿਕਾਰ ਵਿੱਚ ਵਿਚਾਰ ਮੈਮਮ ਕਰਦੀ ਹੈ ਪੰਜਾਬ ਅਤੇ ਕਈ ਮੁਦਗਨਿੰਗ ਅਤੇ ਪੈਕਜ਼ਿੰਗ ਸੰਸਥਾਵਾਂ ਦੇ ਨੇ ਵੀ ਰਾਜ ਵਿੱਚ ਕਾਰੋਬਾਰ ਸਬੰਧੀਆਂ ਮਾਮਲਿਆਂ ਨੂੰ ਮਾਮਲਿਆਂ ਵਿੱਚ ਹਿੱਤਾਂ ਦੀ ਨੁਮਾਇੰਦੀ ਕੀਤੀ ਹੈ ਇਹਨਾਂ ਸੰਸਥਾਵਾਂ ਵਿੱਚ ਭਾਰਤੀ ਛਪਾਈ ਪੈਕੇ ਅਤੇ ਸਹਿਯੋਗ ਮਸ਼ੀਨੀ ਦੀ ਮਾਤਰਾ ਸੰਗ ਉਦੱਤੀ ਮਹੱਤਵਪੂਰਨ ਹੋਣ ਜੋ ਛਪਾਈ ਪੈਕੇਜ਼ ਅਤੇ ਸਹਿਯੋਗ ਸੈਕਟਰ ਦੇ ਨੂੰ ਸਹਾਰਾ ਪ੍ਰਦਾਨ ਕਰਦੀ ਹੈ ਧੰਨਵਾਦ ਜੀ